ਯੋਗਾ ਦਾ ਨਾ ਹਰ ਇੱਕ ਆਸਨ ਜਿਹੜਾ ਮਰਜ਼ੀ ਆਸਨ ਆ ਉਹ ਕਿਤੇ ਨਾ ਕਿਤੇ ਕਿਸੇ ਵੀ ਮੀਡੀਅਮ ਦੇ ਥਰੂ ਆਪਣੀ ਬੋਡੀ ਦੀ ਫਲੈਕਸੀਬਿਲਟੀ ਵਧਾਉਂਦਾ ਫੌਰ ਐਗਜ਼ੈ ਜਿਵੇਂ ਕਿ ਆਪਾਂ ਸ ਬ੍ਰੀਦਿੰਗ ਐਕਸਸਾਈਜ਼ਿਸ ਕਰਦੇ ਹਾਂ ਹੈ ਨਾ ਓਮ ਬਲੋਮ ਹੋ ਗਿਆ ਤਾਂ ਉਹਦੇ ਨਾਲ ਪਹਿਲਾਂ ਤਾਂ ਆਪਣੀ ਜਿਹੜੀ ਦਿਲ ਦੀ ਰਿੱਧਮ ਹੈ ਦਿਲ ਦੀ ਰਿੱਧਮ ਸਟੇਬਲ ਰਹਿੰਦੀ ਹੈ ਸਥਿਰ ਰਹਿੰਦੀ ਹੈ ਪਲਜ਼ ਵੀ ਸਥਿਰ ਰਹਿੰਦੀ ਹੈ ਅਤੇ ਓਵੇਂ ਆਪਣੇ ਜੇ ਆਪਾਂ ਫਲੈਕਸੀਬਿਲਟੀ ਦੀ ਗੱਲ ਕਰੀਏ ਮਤਲਬ ਆਪਾਂ ਮੇਨ ਜਾਂ ਸਾਰਾ ਧਿਆਨ ਜੇ ਆਪਾਂ ਫਲੈਕਸੀਬਿਲਟੀ 'ਤੇ ਦੇਈਏ ਤਾਂ ਆਪਣਾ ਤਾੜ ਆਸਨ ਵੀ ਹੈ ਉਹ ਹੋਰ ਆਪਾਂ ਤ੍ਰਿਕੋਣ ਆਸਨ ਹੋ ਗਿਆ ਅਤੇ ਇੱਕ ਸੂਰਯ ਨਮਸਕਾਰ ਵੀ ਹੁੰਦਾ ਜੋ ਕਿ ਬਹੁਤ ਫਾਇਦੇਮੰਦ ਹੈ ਲਚਕਤਾ ਆਉਂਦੀ ਹੈ ਪੂਰੇ ਸਰੀਰ ਅਤੇ ਹੈ ਅਤੇ ਤਾੜ ਆਸਨ ਵਗੈਰਾ ਨਾਲ ਤ੍ਰਿਕੋਣ ਆਸਨ ਨਾਲ ਇਹਨਾਂ ਨਾਲ ਲਚਕਤਾ ਤਾਂ ਆਉਂਦੀ ਹੀ ਆਉਂਦੀ ਹੈ ਅਤੇ ਨਾਲ ਇਹਨਾਂ ਨਾਲ ਬੱਚਿਆਂ ਦੀ ਜਾਂ ਬੰਦਿਆਂ ਦੀ ਜੋ ਕਿ ਹਾਈਟ ਹੈ ਉਹ ਵੀ ਵਧਦੀ ਹੈ ਲੰਬਾਈ 'ਚ ਵੀ ਵਾਧਾ ਹੁੰਦਾ